ਜਿਵੇਂ ਕਿ ਲਿੰਗ ਅਸਮ ਅਸਮਾਨਤਾ ਖੇਡਾਂ ਵਿੱਚ ਔਰਤਾਂ ਅਤੇ ਮਰਦਾਂ ਵਿੱਚ ਫ਼ਰਕ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਕਿ ਕੁਝ ਖੇਤਰ ਹਨ ਜਿਵੇਂ ਔਰਤਾਂ ਨੂੰ ਦਬਾ ਕੇ ਰੱਖਿਆ ਜਾਂਦਾ ਹੈ ਔਰਤਾਂ ਨੂੰ ਘਰੋਂ ਬਾਹਰ ਜਾ ਕੇ ਖੇਡਣ ਦਾ ਅਧਿਕਾਰ ਨਹੀਂ ਹੁੰਦਾ ਹੈ ਸਰਕਾਰ ਇਹਨਾਂ ਲੋਕਾਂ ਨੂੰ ਔਰਤਾਂ ਵਿੱਚ ਲੁਕੀ ਖੂਬੀ ਬਾਰੇ ਸਮਝਾਉਂਦੀ ਹੈ ਅਤੇ ਸਰਕਾਰ ਇਹਨਾਂ ਔਰਤਾਂ ਲਈ ਇਨ ਇਹਨਾਂ ਦੇ ਤੌਰ 'ਤੇ ਪੈਸੇ ਵੀ ਘੱਟ ਰੱਖੇ ਜਾਂਦੇ ਹਨ ਤਾਂ ਜੋ ਔਰਤਾਂ ਵੀ ਖੇਡ ਸਕਣ ਖੇਡ ਕੇ ਆਪਣਾ ਨਾ ਰੋਸ਼ਨ ਕਰ ਸਕਣ ਕੁਝ ਖੇਡਾਂ ਵਿੱਚ ਕੋਚ ਵੱਲੋਂ ਅਸਮਾਨਤਾ ਕੀਤੀ ਜਾਂਦੀ ਹੈ ਉਹਨਾਂ ਨੂੰ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਸਰਕਾਰ ਨੂੰ ਪੰਜਾਹ ਪ੍ਰਤੀਸ਼ਤ ਔਰਤਾਂ ਅਤੇ ਪੰਜਾਹ ਪ੍ਰਤੀਸ਼ਤ ਮਰਦਾਂ ਦੀਆਂ ਸੀਟਾਂ ਰੱਖੀਆਂ ਹੋਈਆਂ ਹਨ ਜਿਨ੍ਹਾਂ ਵਿੱਚ ਬਰਾਬਰ ਅਸਮਾਨਤਾ ਮਿਲਦੀ ਹੈ